ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਮੈਨੂੰ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਹਾਂਜੀ ਹਾਂਜੀ ਸਰ ਬਾਕੀ ਆਪਣੇ ਇੱਥੇ ਇੰਸਟੀਚਿਊਟ ਵੀ ਕਾਫੀ ਹੈਗੇ ਨੇ ਇਹਨਾਂ ਦੇ ਵਿੱਚ ਕੋਆਰਡੀਨੇਟਰ ਵਗੈਰਾ ਜਿੱਦਾਂ ਰਿਲੇਟਿਡ ਟੂ ਸੋਫਟਵੇਅਰ ਉਹ ਜੋਬਸ ਵੀ ਅਵੇਲੇਬਲ ਨੇ ਬਾਕੀ ਜੇ ਤੁਹਾਡਾ ਇੰਟਰਸਟ ਟੀਚਿੰਗ ਦੇ ਵਿੱਚ ਆ ਤਾਂ ਆਪਣੇ ਇੱਥੇ ਐਸ ਜੀ ਪੀ ਸੀ ਦਾ ਵਿੱਦਿਅਕ ਅਧਾਰਾ ਏ ਜਿਸਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲੇਜ ਆ ਅਤੇ ਉੱਥੇ ਹੁਣ ਅਸਿਸਟੈਂਟ ਪ੍ਰੋਫੈਸਰ ਦੀ ਜੋਬ ਦੀ ਵਕੈਂਸੀ ਖਾਲੀ ਸੀਗੀ ਅਤੇ ਤੁਸੀਂ ਉਹਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਅੱਗੇ ਗੱਲ ਕਰ ਲੂੰਗੀ ਆਪਣੇ ਸੀਨੀਅਰਸ ਨਾਲ ਹਾਂਜੀ ਹਾਂਜੀ ਬਾਕੀ ਨਾ ਤੁਸੀਂ ਮੈਨੂੰ ਆਪਣਾ ਰਿਸਿਉਮੇ ਅਤੇ ਸਾਰੇ ਜਿੰਨੇ ਵੀ ਤੁਹਾਡੇ ਸਰਟੀਫਿਕੇਟਸ ਵਗੈਰਾ ਨੇ ਉਹਨਾਂ ਦੀ ਸਾਰਿਆਂ ਦੀ ਪੀ ਡੀ ਐਫ ਬਣਾ ਕੇ ਨਾ ਮੇਲ ਭੇਜ ਦਿਓ ਮੈਂ ਤੁਹਾਨੂੰ ਮੇਲ ਆਈ ਡੀ ਸੈਂਡ ਕਰ ਦਿੰਦੀ ਹਾਂ ਆਪਣੀ ਵਸਟਐਪ ਕਰ ਦਿੰਦੀ ਹਾਂ ਇਸ ਨੰਬਰ 'ਤੇ ਤੁਹਾਡੀ ਵਸਟਐਪ ਚੱਲਦੀ ਆ ਸਰ ਹਾਂਜੀ ਹਾਂਜੀ ਵਧੀਆ ਸਰ ਪੇ ਸਕੇਲ ਹਾਂਜੀ ਸਰ ਪੇ ਸਕੇਲ ਵੀ ਕਾਫੀ ਅੱਛਾ ਇੱਥੇ ਥਰਟੀ ਫਾਇਵ ਥਾਊਜ਼ੈਂਡ ਹਾਂਜੀ ਹਾਂਜੀ ਬਾਕੀ ਸਰ ਜਿਹੜੇ ਇਨਸੀਨੀਟਿਵ ਨੇ ਉਹ ਵੀ ਟਾਈਮਲੀ ਲੱਗਦੇ ਰਹਿੰਦੇ ਨੇ ਅਤੇ ਬਾਕੀ ਇੱਥੇ ਫਲੈਟਸ ਵਗੈਰਾ ਦੀ ਫੈਸਿਲਿਟੀ ਵੀ ਹੈਗੀ ਆ ਕਿ ਜੇ ਤੁਸੀਂ ਇੱਥੇ ਰਹਿਣਾ ਹੋਵੇ ਹਾਂਜੀ ਹਾਂਜੀ ਚਲੋ ਸਰ ਤੁਸੀਂ ਮੈਨੂੰ ਇੱਦਾਂ ਕਰੋ ਹਾਂਜੀ ਹਾਂਜੀ ਤੁਸੀਂ ਨਾ ਮੈਂ ਤੁਹਾਨੂੰ ਵਟਸਐਪ ਕਰ ਰਹੀ ਹਾਂ ਤੁਸੀਂ ਮੇਲ ਆਈ ਡੀ ਉਸ 'ਤੇ ਮੈਨੂੰ ਮੇਲ ਕਰ ਦਿਉ ਹਾਂਜੀ ਹਾਂਜੀ ਓਕੇ ਸਰ ਬਾਕੀ ਤੁਸੀਂ ਵਿਜਿਟ ਕਰ ਲਿਓ ਸਾਡੇ ਔਫਿਸ ਜੇ ਕਰਨਾ ਹਾਂਜੀ ਓਕੇ